ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਆਵਾਜਾਈ ਦੀ ਟੈਕਨੋਲੋਜੀ ਜਿਹੜੀ ਹੈਗੀ ਹੈ ਟੈਕਨੋਲੋਜੀ ਦਾ ਉਦਯੋਗ ਹੈ ਉਹਦੇ 'ਚ ਕਿਸ ਤਰ੍ਹਾਂ ਨਾਲ ਵਾਧਾ ਹੋਇਆ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਅਤੇ ਇਹਦੇ 'ਚ ਕਿਵੇਂ ਹੈ ਕਿ ਆਪਾਂ ਰੇਲਵੇ ਜਿਵੇਂ ਰੇਲਵੇ ਬੁਕਿੰਗ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਤਾਂ ਆਪਣਾ ਜਿਹੜਾ ਪੁਰਾਣਾ ਮੈਥਡ ਹੈ ਜਿਹੜਾ ਆਪਾਂ ਰੇਲਵੇ ਸਟੇਸ਼ਨ 'ਤੇ ਜਾਂਦੇ ਹਾਂ ਅਤੇ ਟਿਕਟਸ ਬੁੱਕ ਕਰਾਉਂਦੇ ਹਾਂ ਉਹ ਵੀ ਬੜੀ ਜਲਦੀ ਹੋ ਜਾਂਦੀਆਂ ਅੱਜ ਕੱਲ੍ਹ ਬੱਸਾਂ ਦੀ ਟ੍ਰੇਨਾਂ ਦੀ ਅਤੇ ਹਵਾਈ ਜਿਹੜੀਆਂ ਟਿਕਟਾਂ ਹੈਗੀਆਂ ਉਹ ਅੱਜ ਕੱਲ੍ਹ ਓਨਲਾਈਨ ਵੀ ਆਪਾਂ ਘਰ ਬੈਠੇ ਆਪਦੇ ਫੋਨ ਤੋਂ ਜਾਂ ਫਿਰ ਲੈਪਟੋਪ ਤੋਂ ਕਰ ਸਕਦੇ ਹਾਂ ਕਈ ਤਰ੍ਹਾਂ ਦੀ ਵੈਬਸਾਈਟਸ ਹੈਗੀਆਂ ਜਿਵੇਂ ਰੇਲਵੇ ਦੀ ਆਈ ਆਰ ਸੀ ਟੀ ਸੀ ਦੀ ਹੈਗੀ ਹੈ ਅਤੇ ਆਪਾਂ ਬਸ ਬਸ ਟਿਕਟ ਬੁੱਕ ਕਰਨੀ ਹੁੰਦੀ ਹੈ ਉਹਦੇ ਲਈ ਕਈ ਐਪਸ ਵੀ ਹੈਗੀਆਂ ਰੈਡ ਬਸ ਹੈਗੀ ਹੈ ਵੀਗੋ ਐਪ ਹੈਗੀ ਹੈ ਰੇਲਵੇ ਲਈ ਵੀ ਵੀਗੋ ਐਪ ਹੈਗੀ ਹੈ ਹਵਾਈ ਜਹਾਜ਼ ਲਈ ਵੀ ਵੀ ਵੀਗੋ ਹੈਗੀ ਹੈ ਇਸ ਤਰ੍ਹਾਂ ਨਾਲ ਆਪਾਂ ਬੜੀ ਆਸਾਨੀ ਨਾਲ ਘਰ ਬੈਠੇ ਇੱਕ ਔਨਲਾਈਨ ਐਪ ਤੋਂ ਆਪਾਂ ਬੁਕਿੰਗ ਕਰ ਸਕਦੇ ਹਾਂ ਅਤੇ ਹੋਰ ਕੀ ਹੈ ਅੱਜ ਕੱਲ੍ਹ ਕਿ ਇਹਦੇ 'ਚ ਡਿਫਰੈਂਟ ਡਿਫਰੈਂਟ ਵੱਖਰੇ ਵੱਖਰੇ ਡਿਸਕਾਊਂਟ ਚਲਦੇ ਨੇ ਜੇ ਆਪਾਂ ਓਨਲਾਈਨ ਬੁਕਿੰਗ ਕਰਦੇ ਹਾਂ ਤਾਂ ਬਹੁਤ ਜਲਦੀ ਬੁਕਿੰਗ ਹੋ ਜਾਂਦੀ ਹੈ ਇਹਦੇ ਹੋਰ ਕੀ ਆਪਾਂ ਜਦੋਂ ਆਪਾਂ ਟਰੈਵਲ ਕਰਦੇ ਹਾਂ ਆਪਾਂ ਕਿਤੇ ਯਾ ਯਾਤਰਾ ਕਰਦੇ ਹਾਂ ਅਤੇ ਉੱਥੇ ਜਾ ਕੇ ਆਪਾਂ ਨੂੰ ਲੋੜ ਪੈਂਦੀ ਹੋਟਲਾਂ ਦੀ ਉਹ ਵੀ ਓਯੋ ਵੀਗੋ ਅਲੱਗ ਅਲੱਗ ਐਪਸ ਹੈਗੀਆ ਬੜੇ ਆਰਾਮ ਨਾਲ ਆਪਾਂ ਬੁੱਕ ਕਰ ਸਕਦੇ ਹਾਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ